ਮੈਂ ਚਾਵਲਾ ਰੈਸਟੋਰੈਂਟ ਵਿੱਚ ਖਾਣਾ ਓਡਰ ਕਰਿਆ ਅਤੇ ਉਸ 'ਤੇ ਸਮਾਂ ਤੀਹ ਮਿੰਟ ਦਿਖਾ ਰਿਹਾ ਸੀ ਅਤੇ ਹੁਣ ਇਕ ਘੰਟਾ ਹੋ ਗਿਆ ਮੇਰਾ ਓਡਰ ਨਹੀਂ ਪਹੁੰਚਿਆ ਤਾਂ ਮੈਂ ਕਾਰਵਾਈ ਕਰ ਰਿਹਾ ਹਾਂ ਕਿ ਮੇਰਾ ਓਡਰ ਅਜੇ ਤੱਕ ਨਹੀਂ ਪਹੁੰਚਿਆ ਮੇਰਾ ਓਡਰ ਜਲਦ ਤੋਂ ਜਲਦ ਪਹੁੰਚਾ ਦੇਣ ਕਿ ਅਸੀਂ ਖਾਣਾ ਦੁਬਾਰਾ ਵੀ ਮੰਗਾ ਕੁਛ ਵੀ ਚੀਜ਼ ਦੁਬਾਰਾ ਮੰਗਾ ਸਕੀਏ ਇਸ ਕਰਕੇ ਜਲਦ ਤੋਂ ਜਲਦ ਮੇਰਾ ਓਡਰ ਭੇਜਣ